ਹਾਂ ਹਾਲ ਹੀ ਦੇ ਸਾਲਾਂ ਵਿੱਚ ਡਾਂਸਿਕ ਵਿੱਚ ਕਾਫੀ ਬਦਲਾਅ ਆਇਆ ਹੈ ਆਧੁਨਿਕ ਡਾਂਸ ਦੇ ਰੁਝਾਨ ਤਕਨਾਲੋਜੀ ਅਤੇ ਸ਼ੋਸ਼ਲ ਮੀਡੀਆ ਦੁਆਰਾ ਬਹੁਤ ਜ਼ਿਆਦਾ ਪ੍ਰਭਾਵਿਤ ਹਨ ਜਿਹਨਾਂ ਨੇ ਨਵੀਆਂ ਸ਼ੈਲੀਆਂ ਅਤੇ ਰੂਟੀਨ ਦੇ ਪ੍ਰਸਾਰ ਨੂੰ ਤੇਜ਼ ਕੀਤਾ ਹੈ ਟਿਕ ਟੋਕ ਅਤੇ ਇੰਸਟਾਗਰਾਮ ਵਰਗੇ ਪਲੇਟਫਾਰਮਾਂ ਨੇ ਡਾਂਸ ਦਾ ਲੋਕਤੰਤਰੀਕਰਨ ਕੀਤਾ ਹੈ ਜਿਸ ਵਿੱਚ ਵਾਇਰਲ ਰੁਝਾਨਾਂ ਨੂੰ ਤੇਜ਼ੀ ਨਾਲ ਵਿਸ਼ਵ ਪ੍ਰਸਿੱਧੀ ਪ੍ਰਾਪਤ ਹੋ ਸਕਦੀ ਹੈ ਇਹ ਪੁਰਾਣੇ ਨਾਚ ਰੂਪਾਂ ਦੇ ਨਾਲ ਤਿੱਖੇ ਤੌਰ 'ਤੇ ਉਲਟ ਹੈ ਜੋ ਅਕਸਰ ਸੱਭਿਆਚਾਰਕ ਪਰੰਪਰਾਵਾਂ ਵਿੱਚ ਜੜ੍ਹੀਆਂ ਹੁੰਦੀਆਂ ਸਨ ਅਤੇ ਖਾਸ ਸਮਾਜਿਕ ਜਾਂ ਰਸਮੀ ਸੰਦਰਭਾਂ ਵਿੱਚ ਕੀਤੀਆਂ ਜਾਂਦੀਆਂ ਸਨ ਰਵਾਇਤੀ ਨਾਚ ਜਿਵੇਂ ਕਿ ਕਲਾਸੀਕਲ ਬੈਲੇ ਜਾਂ ਲੋਕ ਨਾਚ ਉਹਨਾਂ ਦੇ ਸਮਿਆਂ ਦੇ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਵ ਨੂੰ ਦਰਸਾਉਂਦੇ ਹੋਏ ਢਾਂਚਾਗਤ ਤਕਨੀਕਾਂ ਅਤੇ ਰਸਮੀ ਪ੍ਰਦਰਸ਼ਨਾਂ 'ਤੇ ਜ਼ੋਰ ਦਿੰਦੇ ਹਨ ਇਸ ਦੇ ਉਲਟ ਸਮਕਾਲੀ ਡਾਂਸ ਅਕਸਰ ਵਿਅਕਤੀਗਤ ਪ੍ਰਗਟਾਵੇ 'ਤੇ ਜ਼ੋਰ ਦਿੰਦੇ ਹਨ ਅਤੇ ਵੱਖ ਵੱਖ ਸ਼ੈਲੀਆਂ ਨੂੰ ਮਿਲਾਉਂਦੇ ਹਨ ਹੀਪ ਹੋਪ ਸਮਕਾਲੀ ਅਤੇ ਇੱਥੋਂ ਤੱਕ ਕਿ ਡਿਜੀਟਲ ਅੰਦੋਲਨਾਂ ਦੇ ਤੱਤ ਵੀ ਸ਼ਾਮਿਲ ਕਰਦੇ ਹਨ ਡਾਂਸ ਚੁਣੌਤੀਆਂ ਅਤੇ ਓਨਲਾਈਨ ਟਿਊਟੋਰੀਅਲਸ ਦੇ ਉਭਾਰ ਨੇ ਡਾਂਸ ਨੂੰ ਵਧੇਰੇ ਪਹੁੰਚਯੋਗ ਅਤੇ ਵਿਭਿੰਤਾ ਬਣਾ ਦਿੱਤਾ ਹੈ ਸ਼ੈਲੀ ਦੇ ਸੰਯੋਜਨ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਰਵਾਇਤੀ ਰੂਪਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਬਜਾਏ ਨਿੱਜੀ ਰਚਨਾਤਮਕਤਾਂ 'ਤੇ ਧਿਆਨ ਕੇਂਦਰਿਤ ਕੀਤਾ ਹੈ ਇਹ ਵਿਕਾਸ ਕਲਾਤਮਕ ਪ੍ਰਗਟਾਵੇ ਵਿੱਚ ਸਮਾਵੇਸ਼ ਅਤੇ ਨਵੀਨਤਾ ਵੱਲ ਵਿਆਪਕ ਸੱਭਿਆਚਾਰਕ ਤਬਦੀਲੀਆਂ ਨੂੰ ਦਰਸਾਉਂਦਾ ਹੈ